ਹੈਲੋ ਤੁਸੀਂ ਸੁਰਿੰਦਰ ਆਟੋ ਵਾਲੇ ਬੋਲ ਰਹੇ ਹੋ ਦਰਅਸਲ ਮੈਂ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਤੋਂ ਅਰਸ਼ਦੀਪ ਸਿੰਘ ਗੱਲ ਕਰ ਰਿਹਾ ਮੈਂ ਬਠਿੰਡੇ ਜਾਣਾ ਸੀ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਤੋਂ ਬਠਿੰਡੇ ਸ਼ਹਿਰ ਜਾਣਾ ਸੀ ਕੁਛ ਕਿਤਾਬਾਂ ਲੈਣ ਵਾਸਤੇ ਅਤੇ ਮੈਨੂੰ ਇੱਕ ਡੇਢ ਘੰਟਾ ਹੀ ਲੱਗੇਗਾ ਜਾਣਾ ਤਾਂ ਮੈਂ ਪੱਚੀ ਤਰੀਕ ਪੱਚੀ ਮਈ ਦੋ ਹਜ਼ਾਰ ਚੌਵੀ ਨੂੰ ਹੈ ਅਤੇ ਸ਼ਾਮ ਛੇ ਕੁ ਵਜੇ ਨਿਕਲੂੰਗਾ ਲੂੰਗਾ ਅਤੇ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਇੱਕ ਡੇਢ ਘੰਟਾ ਹੀ ਲੱਗੇਗਾ ਅਤੇ ਫਿਰ ਤੁਸੀਂ ਮੈਨੂੰ ਅਕੈਡਮਿਕ ਬਲੋਕ ਤੋਂ ਪਿੱਕ ਕਰ ਲਿਓ ਜੇ ਮੈਂ ਤੁਹਾਨੂੰ ਦੱਸਾਂ ਤੁਸੀਂ ਇੱਕ ਵਾਰੀ ਸੈਂਟਰਲ ਯੂਨੀਵਰਸਿਟੀ ਆਫ ਪਜ ਪੰਜਾਬ ਪਹੁੰਚ ਕੇ ਨਾ ਪਹਿਲੇ ਗੇਟ 'ਚੋਂ ਐਂਟਰ ਕਰੋਗੇ ਸੱਚ ਪਹਿਲਾ ਗੇਟ ਆ ਜਿਹੜਾ ਉਹ ਬੰਦ ਹੈ ਤੁਸੀਂ ਦੂਸਰੇ ਗੇਟ ਤੋਂ ਐਂਟਰ ਕਰਿਓ ਜਿਹੜਾ ਪੰਜਾਬੀ ਯੂਨੀਵਰਸਿਟੀ ਕਾਲਜ ਘੁਦੇ ਕਨੀਓ ਹੋਏਗਾ ਤੁਸੀਂ ਦੂਸਰੇ ਗੇਟ 'ਚ ਜਦੋਂ ਐਂਟਰ ਕਰੋਂਗੇ ਐਂਟਰੀ ਕਰਾ ਕੇ ਸਿਕਿਉਰਟੀ ਗਾਰਡ ਕੋਲ ਤੁਸੀਂ ਅੰਦਰ ਆ ਜਾਇਓ ਅਤੇ ਅੰਦਰ ਆ ਕੇ ਤੁਸੀਂ ਸਿਕਿਓਰਟੀ ਗਾਰਡ ਨੇ ਤੁਹਾਨੂੰ ਦੱਸ ਦੇਣਾ ਵੈਸੇ ਤਾਂ ਕਿ ਅਕੈਡਮਿਕ ਬਲੋਕ ਕਿੱਧਰ ਹੈ ਅਤੇ ਅਕੈਡਮੀ ਬਲੋਕ ਪਹੁੰਚ ਕੇ ਤੁਸੀਂ ਜਿਹੜਾ ਛੋਟਾ ਗੇਟ ਹੋਏਗਾ ਤੁਸੀਂ ਉਧਰਲੀ ਸਾਈਡ ਆ ਜਾਇਓ ਛੋਟਾ ਗੇਟ ਵੈਸੇ ਤਾਂ ਦੋ ਗੇਟ ਨੇ ਇੱਕ ਵੱਡਾ ਇੱਕ ਛੋਟਾ ਅਕੈਡਮਿਕ ਬਲੋਕ ਦਾ ਜਿਹੜਾ ਅ ਖੱਬੇ ਪਾਸੇ ਤੁਹਾਨੂੰ ਮਿਲੇਗਾ ਵੈਸੇ ਜੇ ਨਾ ਵੀ ਤੁਹਾਨੂੰ ਪਤਾ ਲੱਗਿਆ ਤਾਂ ਤੁਸੀਂ ਕਿਸੇ ਬੱਚੇ ਨੂੰ ਕੋਈ ਨੇੜੇ ਤੇੜੇ ਹੋਏਗਾ ਉਹਨੂੰ ਤੁਸੀਂ ਪੁੱਛ ਸਕਦੇ ਹੋ ਬਾਕੀ ਮੈਂ ਲੋਕੇਸ਼ਨ ਤਾਂ ਲਾਈ ਓ ਹੋਈ ਆ ਤੁਸੀਂ ਲੋਕੇਸ਼ਨ 'ਚ ਵੀ ਦੇਖ ਕੇ ਆ ਸਕਦੇ ਹੋ ਅਤੇ ਬਾਕੀ ਤੁਸੀਂ ਪੁੱਛ ਲਿਓ ਇੱਕ ਵਾਰੀ ਵੀ ਦੂਜਾ ਗੇਟ ਆ ਜਿਹੜਾ ਮਿਊਜ਼ੀਅਮ ਵਾਲੀ ਸਾਈਡ ਗੇਟ ਆ ਉੱਥੇ ਖੜ੍ਹ ਜਾਇਓ ਤੁਸੀਂ ਅਤੇ ਮੈਂ ਉੱਥੇ ਆ ਕੇ ਉੱਥੇ ਮੈਂ ਸ਼ਾਮ ਛੇ ਵਜੇ ਪੂਰੇ ਖੜ੍ਹ ਜੂੰਗਾ ਅਤੇ ਬਾਕੀ ਤੁਸੀਂ ਪਹੁੰਚ ਕੇ ਮੈਨੂੰ ਕਾਲ ਵੀ ਕਰ ਦਿਓ ਇੱਕ ਵਾਰੀ ਤਾਂ ਫਿਰ ਉਸੇ ਟਾਈਮ ਛੇ ਵਜੇ ਮੈ ਮੈਂ ਨਿਕਲ ਜੂੰਗਾ ਤੁਹਾਡੇ ਨਾਲ